ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਮੈਮ ਹਾਂਜੀ ਮੈਮ ਅੱਛਾ ਜੀ ਨਹੀਂ ਮੈਮ ਪਹਿਲੇ ਤਾਂ ਠੀਕ ਸੀਗੇ ਹੁਣ ਥੋੜ੍ਹੀ ਪ੍ਰੋਬਲਮ ਆਉਂਦੀ ਹੋਣੀ ਆ ਹਾਂਜੀ ਮੈਮ ਅੱਛਾ ਮੈਮ ਕੋਈ ਨਾ ਮੈਮ ਕਹਿ ਦਾ ਸਮਝਾਵਾਂਗੇ ਬੱਚੇ ਨੂੰ ਠੀਕ ਹੈ ਮੈਮ ਕੋਈ ਨਾ ਟਿਊਸ਼ਨ ਲਗਵਾ ਦਿੰਦੇ ਹਾਂ ਹੋਰ ਧਿਆਨ ਦੇਵਾਂਗੇ ਨਹੀਂ ਨਹੀਂ ਮੈਮ ਬਹੁਤ ਵਧੀਆ ਗੱਲ ਆ ਇਹ ਤਾਂ ਚਲੋ ਖੇਲਣਗੇ ਵਧੀਆ ਏ ਹਾਂਜੀ ਹਾਂਜੀ ਹਾਂਜੀ ਲੈ ਜਿਓ ਜ਼ਰੂਰ ਠੀਕ ਹੈ ਮੈਮ ਲੈ ਜਿਓ ਜੀ ਠੀਕ ਹੈ ਮੈਮ ਕੋਈ ਨਾ ਜੀ ਧਿਆਨ ਦੇਵਾਂਗੇ ਠੀਕ ਹੈ